ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਉੱਨੀ ਸੌ ਪੰਜ ਵਿੱਚ ਬੰਗਾਲ ਦੀ ਵੰਡ ਹੋਈ ਜਿਸ ਵਿੱਚ ਬੰਗਾਲ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਗਿਆ ਇਸ ਤੋਂ ਬਾਅਦ ਉੱਨੀ ਸੌ ਸੋਲਾਂ ਵਿੱਚ ਕਾਂਗਰਸ ਦੇ ਦੋ ਭਾਗ ਬਣ ਗਏ ਇੱਕ ਗਰਮ ਦਲ ਇੱਕ ਅਤੇ ਨਰਮ ਦਲ ਅਤੇ ਉਸ ਤੋਂ ਬਾਅਦ ਉੱਨੀ ਸੌ ਉੱਨੀ ਵਿੱਚ ਜਲ੍ਹਿਆਂਵਾਲੇ ਬਾਗ ਦਾ ਕਤਲੇਆਮ ਹੋਇਆ ਜਿਸ ਵਿੱਚ ਆਮ ਬਹੁਤ ਸਾਰੇ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਅੰਗਰੇਜ਼ਾਂ ਨੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉੱਨੀ ਸੌ ਸੰਤਾਲੀ ਦੀ ਵੰਡ ਦਾ ਪੰਜਾਬ ਦੇ ਖੇਤਰਾਂ 'ਤੇ ਬਹੁਤ ਪ੍ਰਭਾਵ ਪਿਆ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਇੱਕ ਭਾਗ ਜਿਸ ਨੂੰ ਕਿ ਪਾਕਿਸਤਾਨ ਕਿਹਾ ਜਾਂਦਾ ਹੈ ਜ਼ਿਆਦਾਤਰ ਪੰਜਾਬੀ ਬੋਲਣ ਵਾਲੇ ਲੋਕ ਉਸ ਭਾਗ ਵਿੱਚ ਹੀ ਰਹਿ ਗਏ ਹਨ